ਹੈਲੋ ਹਾਂਜੀ ਹੈਲੋ ਸਰ ਜੀ ਮੈਂ ਠੀਕ ਜਿਹਾ ਨਹੀਂ ਰਿਹਾ ਸੀ ਇਸ ਕਰਕੇ ਸਰ ਜੀ ਬਾ ਬੁਖਾਰ ਚੜਦਾ ਪਿਆ ਸੀ ਜਿਹੜਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਵਾਇਰਲ ਹੁੰਦਾ ਪਿਆ ਵਾ ਅਤੇ ਉਹ ਹਫ਼ਤਾ ਕੁ ਰਿਹਾ ਅਤੇ ਤਾਂ ਕਰਕੇ ਮੈਂ ਰਾਤ ਬਿਮਾਰ ਬਹੁਤ ਜ਼ਿਆਦਾ ਹੋ ਗਿਆ ਸੀ ਮੈਂ ਇਸ ਕਰਕੇ ਨਹੀਂ ਆ ਪਾਇਆ ਹਾਂਜੀ ਹਾਂਜੀ ਸਰ ਮੈਨੂੰ ਕਲਾਸ 'ਚ ਬੱਚੇ ਬਹੁਤ ਤੰਗ ਕਰਦੇ ਆ ਅਤੇ ਜੇ ਮੈਂ ਕੋਈ ਬੋਲਾਂ ਵੀ ਅਤੇ ਮਾੜਾ ਜਿਹਾ ਬੋਲਾਂ ਤਾਂ ਮੇਰੀ ਸ਼ਿਕਾਇਤ ਲਾ ਦਿੰਦੇ ਜਾ ਕੇ ਬਿਨਾਂ ਵਜ੍ਹਾ ਝੂਠੀ ਸਰ ਜੀ ਹੈ ਫਿਰ ਤਾਂ ਕਰਕੇ ਮੈਨੂੰ ਗੁੱਸਾ ਆ ਜਾਂਦਾ ਮੈਂ ਤਾਂ ਛੁੱਟੀ ਕੀਤੀ ਨਹੀਂ ਨਹੀਂ ਸਰ ਜੀ ਤੁਸੀਂ ਮੇਰੀਆਂ ਮੈਡਮਾਂ ਕੋੋੋਲੋਂ ਪੁੱਛ ਸਕਦੇ ਜੇ ਮੈਂ ਬਹੁਤ ਚੰਗਾ ਬੱਚਾ ਹੈਗਾ ਤੁਸੀਂ ਮੇਰੀਆਂ ਭਾਵੇਂ ਜਿਹੜੀ ਮਰਜ਼ੀ ਟੀਚਰ ਕੋਲ ਜਾ ਕੇ ਪੁੱਛੋ ਲੋ ਮੈਂ ਬਹੁਤ ਵਧੀਆ ਬੱਚਾ ਹਾਂਜੀ ਹਾਂਜੀ ਬੁਖਾਰ ਤਾਂ ਸਰ ਜੀ ਠੀਕ ਹੈ ਠੀਕ ਆ ਦਵਾਈ ਖਾਣਡਿਆਂ ਉਂਝ ਨਹੀਂ ਨਹੀਂ ਸਰ ਜੀ ਛੁੱਟੀਆਂ ਤਾਂ ਮੈਂ ਕਿੱਥੇ ਕਰਨੀਆਂ ਜੇ ਬਸ ਉਹ ਹਾਂਜੀ ਹਾਂਜੀ ਹਾਂਜੀ ਸਰ ਜੀ ਪਤਾ ਕੀ ਗੱਲ ਬੱਚੇ ਜਦੋਂ ਤਮਾਸ਼ਬੀਨੀਆਂ ਕਰਦੇ ਤੁਹਾਨੂੰ ਵੀ ਪਤਾ ਫਿਰ ਕੁਛ ਕਹਿਣ ਜੋਗਾ ਨਹੀਂ ਹੁੰਦਾ ਜਦੋਂ ਦਸ ਬੱਚੇ ਮਿਲ ਗਏ ਇੱਕ ਬੱਚੇ ਦੀ ਕੰਪਲੇਂਟ ਪਾਉਣਗੇ ਸਰ ਨੇ ਤਾਂ ਉਹਨਾਂ 'ਤੇ ਹੀ ਯਕੀਨ ਕਰਨਾ ਮੇਰੇ 'ਤੇ ਥੋੜ੍ਹੀ ਕਰਨਾ ਹਾਂਜੀ ਹਾਂਜੀ ਨਹੀਂ ਨਹੀਂ ਸਰ ਜੀ ਜੇ ਤੁਹਾਨੂੰ ਸਾਡੇ 'ਤੇ ਯਕੀਨ ਆ ਸਰ ਜੀ ਆਪਾਂ ਤੁਹਾਡੇ ਵਧੀਆ ਬੱਚੇ ਆ ਕੋਈ ਸ਼ਿਕਾਇਤ ਨਹੀਂ ਆਏਗੀ ਤੁਹਾਨੂੰ ਨਹੀਂ ਸਰ ਜੀ ਪੜ੍ਹਾਈ ਵਿੱਚੋਂ ਵੀ ਮੈਂ ਬਹੁਤ ਵਧੀਆ ਹੈਗਾ ਤੁਸੀਂ ਮੇਰੇ ਰਿਜ਼ਲਟ ਵੇਖ ਸਕਦੇ ਜੇ ਬਹੁਤ ਵਧੀਆ ਮੈਂ ਸਕੂਲ ਦਾ ਨਾਮ ਰੋਸ਼ਨ ਕਰਦਾ ਰਿਹਾ ਹਾਂ ਨਹੀਂ ਨਹੀਂ ਸਰ ਜੀ ਜਦੋਂ ਤੁਸੀਂ ਕਹਿ ਤਾ ਸਾਡੀ ਕੋਈ ਕੰਪਲੇਂਟ ਨਹੀਂ ਆਏਗੀ ਬਸ ਓ ਹਾਂਜੀ ਹਾਂਜੀ ਘਰ ਵਿੱਚ ਵੀ ਠੀਕ ਆ ਬਸ ਉਹ ਬੱਚਿਆਂ ਕਰਕੇ ਥੋੜ੍ਹਾ ਹੋ ਜਾਂਦਾ ਸੀ ਕਿ ਮੰਨ ਲਓ ਜਿਵੇਂ ਕੋਈ ਬੈਠੇ ਹਾਂ ਅਤੇ ਕਿਸੇ ਪਿੱਛੋਂ ਕਿਸੇ ਨੇ ਤਮਾਸ਼ਬੀਨੀ ਕਰ ਦੇਣੀ ਜਾਂ ਕੁਛ ਕਰ ਦੇਣਾ ਫਿਰ ਮੈਨੂੰ ਗੁੱਸਾ ਆ ਜਾਂਦਾ ਸੀ ਜਾਂ ਫਿਰ ਲੜਾਈ ਵਾਲਾ ਤੁਹਾਨੂੰ ਪਤਾ ਕੰਮ ਹੁੰਦਾ ਲੜਾਈਆਂ ਅੱਜ ਕੱਲ੍ਹ ਦੇ ਸਮੇਂ ਵਿੱਚ ਰਹਿ ਨਹੀਂ ਗਈਆਂ ਅਤੇ ਤਾਂ ਕਰਕੇ ਫਿਰ ਮੈਂ ਛੁੱਟੀ ਕਰਕੇ ਘਰ ਬਹਿ ਜਾਂਦਾ ਨਹੀਂ ਨਹੀਂ ਸਰ ਜੀ ਸ਼ਰਾਰਤੀ ਨਹੀਂ ਹੈਗਾ ਮੈਂ ਨਹੀਂ ਨਹੀਂ ਸਰ ਜੀ ਸ਼ਰਾਰਤੀ ਨਹੀਂ ਲਾਡਲੇ ਤਾਂ ਸਰ ਜੀ ਸਾਰੇ ਹੀ ਹੁੰਦੇ ਹੁਣ ਲਾਡਲੇ ਦੇ ਸਾਰੇ ਹੀ ਹੁੰਦੇ ਆ ਨਹੀਂ ਨਹੀਂ ਕਾਹਦੀ ਕੰਪਲੇਂਟ ਸਰ ਜੀ ਤੁਹਾਨੂੰ ਪਤਾ ਮੈਂ ਇੱਕ ਵਾਰੀ ਕਹਿ ਤਾ ਫਿਰ ਕੰਪਲੇਂਟ ਨਹੀਂ ਹੁੰਦੀ ਮੇਰੀ ਹਾਂਜੀ ਪੇਪਰਾਂ ਦੀ ਤਾਂ ਤਿਆਰੀ ਹੈ ਪੇਪਰਾਂ ਦੀ ਤਿਆਰੀ ਖਿੱਚਣ ਨੇ ਪੂਰੀ ਹੁਣ ਤਾਂ ਫਾਈਨਲ ਇਗਜਾਮ ਹੈਗੇ ਉਹਨਾਂ ਦੀ ਕਰਨੀ ਪੈਣੀ ਹਾਂਜੀ ਹਾਂਜੀ ਠੀਕ ਨਹੀਂ ਨਹੀਂ ਨਹੀਂ ਕੋਈ ਸ਼ਿਕਾਇਤ ਨਹੀਂ ਆਏਗੀ ਕੋਈ ਸ਼ਿਕਾਇਤ ਨਹੀਂ ਆਏਗੀ ਹਾਂ ਤੁਸੀਂ ਭਾਈ ਹੁਣੀ ਹੁਣੇ ਪੁੱਛ ਸਕਦੇ ਜੇ ਉਹਦੀ ਕੋਈ ਟੈਨਸ਼ਨ ਨਹੀਂ ਗੀ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਤਾ ਸੀ ਕਿ ਤੁਸੀਂ ਮੇਰੀ ਮੈਡਮਾਂ ਕੋਲੋਂ ਪੁੱਛ ਸਕਦੇ ਜੇ ਠੀਕ ਹੈ ਠੀਕ ਹੈ ਜੀ ਓਕੇ